ਰਸੋਈ ਵਿੱਚ ਕਈ ਤਰ੍ਹਾਂ ਦੇ ਬਰਤਨ ਹਨ ਜਿਸ ਤਰ੍ਹਾਂ ਕਿ ਪਰਾਤ ਪਲੇਟ ਪਤੀਲੇ ਕੌਲੀ ਚਮਚੇ ਕੜਾਹੀ ਤੜਕੇ ਦਾਨੀ ਨਮਕਦਾਨੀ ਗੜਬੀ ਜੱਗ ਡਰੱਮੀ ਗਲਾਸ

ਕੜਛੀ ਪਰਾਤ ਜਿਸ ਤਰ੍ਹਾਂ ਕਿ ਆਟਾ ਗੁੰਨਣ ਵਾਸਤੇ ਪਲੇਟ ਰੋਟੀ ਰੱਖਣ ਵਾਸਤੇ ਪਤੀਲੇ ਸਬਜ਼ੀ ਬਣਾਉਣ ਵਾਸਤੇ ਕੌਲੀ ਸਬਜ਼ੀ ਪਾਉਣ ਵਾਸਤੇ ਚਮਚੇ ਨਾਲ ਅਸੀਂ ਖਾਂਦੇ ਹਾਂ ਕੜਾਹੀ ਵਿੱਚ ਦੁੱਧ ਉਬਾਲਦੇ ਹਾਂ ਤੜਕੇ ਦਾਨੀ ਵਿੱਚ ਸਬਜ਼ੀ ਨੂੰ ਤੜਕਾ ਲਗਾਉਂਦੇ ਹਾਂ ਨਮਕਦਾਨੀ ਵਿੱਚ ਨਮਕ ਅਤੇ ਹੋਰ ਮਸਾਲੇ ਜਿਹੜੇ ਉਹ ਪਾਉਂਦੇ ਹਾਂ ਗੜਬੀ ਪਾਣੀ ਪੀਣ ਲਈ ਜੱਗ ਪਾਣੀ ਭਰਨ ਲਈ